ਪੰਜਾਬ ਵਿੱਚ ਵਪਾਰਕ ਖੇਤਰ ਸਥਾਨਕ ਕਰਮਚਾਰੀਆਂ ਅਤੇ ਪ੍ਰਤਿਭਾ ਦੇ ਵਿਕਾਸ ਦਾ ਸਮਰਥਨ ਕਰਦਾ ਹੈ ਜੇ ਵਪਾਰਕ ਖੇਤਰ ਵਿੱਚ ਜਿਹੜੇ ਸਥਾਨਕ ਕਰਮਚਾਰੀ ਹਨ ਉਹ ਆਪਣੀ ਪ੍ਰਤਿਭਾ ਨੂੰ ਵਧਾਉਂਦੇ ਹਨ ਆਪਣੇ ਸਕਿੱਲਸ ਨੂੰ ਵਧਾਉਂਦੇ ਹਨ ਤਾਂ ਕਿ ਉਹ ਵਧੀਆ ਤਰ੍ਹਾਂ ਕੰਮ ਕਰ ਸਕਣ ਅੱਜ ਕ ਦੀ ਨਿਊ ਟੈਕਨੋਲੋਜੀ ਦੇ ਨਾਲ ਜਿਹੜੇ ਕਰਮਚਾਰੀ ਹਨ ਉੱਥੋਂ ਆਪਣੇ ਟ੍ਰੇਨਿੰਗ ਲੈ ਸਕਦੇ ਹਨ ਅਤੇ ਉਹਨਾਂ ਦਾ ਵਿਕਾਸ ਹੁੰਦਾ ਹੈ ਇਹ ਬਹੁਤ ਵਧੀਆ ਟ੍ਰੇਨਿੰਗ ਵੀ ਦਿੰਦੇ ਹਨ ਤਾਂ ਕਿ ਜਿਹੜੇ ਵਰਕਰ ਹਨ ਜਾਂ ਕਰਮਚਾਰੀ ਹਨ ਇਹ ਵਧੀਆ ਕੰਮ ਕਰ ਸਕਣ ਅਤੇ ਆਪਣਾ ਵਿਕਾਸ ਕਰ ਸਕਣ ਅਤੇ ਆਪਣੇ ਭਾਰਤ ਆਪਣੇ ਪੰਜਾਬ ਨੂੰ ਵਧੀਆ ਵੈਲ ਲੈਵਲ 'ਤੇ ਲੈ ਕੇ ਜਾ ਸਕਣ ਅਤੇ ਵਪਾਰਕ ਖੇਤਰ ਇਸ ਦੇ ਵਿੱਚ ਮਦਦ ਕਰਦਾ ਹੈ ਵਪਾਰਕ ਖੇਤਰ ਦੇ ਵਿੱਚ ਕਰਮਚਾਰੀਆਂ ਦਾ ਸਕਿੱਲਸ ਅਤੇ ਉਹਨਾਂ ਦਾ ਵਿਕਾਸ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਤਾਂ ਕਿ ਉਹ ਵਧੀਆ ਕਮਾ ਸਕਣ ਅਤੇ ਆਪਣੇ ਪੰਜਾਬ ਨੂੰ ਇੱਕ ਉੱਚੇ ਲੈਵਲ 'ਤੇ ਲੈ ਕੇ ਜਾ ਸਕਣ